ਹੈਲੋ ਮੈਂ ਦਰਪਨਪ੍ਰੀਤ ਬੋਲ ਰਿਹਾ ਕੀ ਤੁਸੀਂ ਸ਼ੀਤਲ ਧਾਬੇ ਢਾਬੇ ਤੋਂ ਬੋਲ ਰਹੇ ਹੋ ਮੈਂ ਕੱਲ੍ਹ ਤੁਹਾਨੂੰ ਇੱਕ ਔਡਰ ਵਾਸਤੇ ਫੋਨ ਕੀਤਾ ਸੀ ਜੋ ਕਿ ਮੇਰੇ ਜਨਮਦਿਨ ਵਾਸਤੇ ਸੀ ਅਤੇ ਉਸ ਚ ਕੋਈ ਪੰਜਾਹ ਜ ਬੰਦਿਆਂ ਦਾ ਖਾਣਾ ਸੀ ਜਿਸ ਵਿੱਚ ਅਸੀਂ ਜਿੱਦਾਂ ਸਟਾਰਟਰ ਵਿੱਚ ਦਹੀਂ ਭੱਲੇ ਤੰਦੂਰੀ ਚਿਕਨ ਐਸੀਆਂ ਚੀਜ਼ਾਂ ਮੰਗਵਾਈਆਂ ਸੀ ਅਤੇ ਮੇਨ ਕੋਰਸ ਵਿੱਚ ਮੈਂ ਸਪੈਸ਼ਲ ਤੁਹਾਨੂੰ ਕਿਹਾ ਸੀ ਕਿ ਕਣਕ ਦੀ ਰੋਟੀ ਹੋਵੇ ਅਤੇ ਮੈਂ ਤੁਹਾਡੇ ਰੈਸਟੋਰੈਂਟ ਤੋਂ ਪਹਿਲੀ ਵਾਰ ਕੁਛ ਔਡਰ ਕੀਤਾ ਸੀ ਮੈਂ ਮੈਨੂੰ ਥੋੜ੍ਹਾ ਜਿਹਾ ਆਪਣੇ ਵੱਲੋਂ ਡਰ ਸੀ ਕਿ ਪਤਾ ਨਹੀਂ ਖਾਣਾ ਕੈਸਾ ਹੋਏਗਾ ਪਰ ਖਾਣਾ ਬਹੁਤ ਅੱਛਾ ਸੀ ਅਤੇ ਜਿੱਦਾਂ ਵੀ ਮੈਂ ਕਿਹਾ ਸੀਗਾ ਤੁਹਾਨੂੰ ਖਾਣਾ ਬਿਲਕੁਲ ਉਵੇਂ ਹੀ ਬਣਿਆ ਸੀਗਾ ਅ ਮੈਂ ਮਸਾਲਾ ਘੱਟ ਰੱਖਣ ਨੂੰ ਕਿਹਾ ਸੀ ਕਿਉਂਕਿ ਸਾਡੇ ਘਰ ਬਜ਼ੁਰਗ ਵੀ ਹਨ ਅਤੇ ਕੁਛ ਜ਼ਿਆਦਾ ਮਿਰਚ ਅ ਖਾਂਦੇ ਨਹੀਂ ਅਤੇ ਖਾਣਾ ਬਹੁ ਬਿਲਕੁਲ ਉਸ ਮੁਤਾਕ ਮੁਤਾਬਿਕ ਹੀ ਬਣਿਆ ਸੀ ਜਿਵੇਂ ਮੈਂ ਕਿਹਾ ਸੀ ਸਭ ਨੂੰ ਖਾਣਾ ਬਹੁਤ ਪਸੰਦ ਆਇਆ ਸਭ ਨੇ ਪੁੱਛਿਆ ਕਿ ਕਿ ਇਹ ਖਾਣਾ ਕਿੱਥੋਂ ਮੰਗਵਾਇਆ ਹੈ ਅਤੇ ਮੈਂ ਤੁਹਾਡੇ ਰੈਸਟੋਰੈਂਟ ਦਾ ਹੀ ਨਾਮ ਦੱਸਿਆ ਹੈ ਮੈਂ ਸਭ ਉ ਉਂਗਲੀਆਂ ਚੱਟਦੇ ਰਹਿ ਗਏ ਅਤੇ ਹੁਣ ਜੇਕਰ ਮੇਰੇ ਆਸ ਪਾਸ ਕਿਤੇ ਕੋਈ ਵੀ ਕਾਰਯਕਰਮ ਹੁੰਦਾ ਹੈ ਮੈਂ ਤੁਹਾਡੇ ਰੈਸਟੋਰੈਂਟ ਬਾਰੇ ਜ਼ਰੂਰ ਦੱਸਾਂਗਾ ਅਤੇ ਅ ਧੰਨਵਾਦ ਤੁਹਾਡਾ ਇਸ ਤੁਹਾਡੇ ਕਰਕੇ ਮੇਰਿਆ ਮੇਰਾ ਜਨਮ ਦਿਨ ਬਹੁਤ ਯਾਦਗਾਰ ਬ ਰਿਹਾ